ਬੱਚਿਆਂ ਐੱਲ ਆਈ ਡਰਾਇੰਗ ਜਾਂ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਸਹੀ ਉਮਰ ਹੈ ਪੰਜ ਤੋਂ ਲੈ ਕੇ ਦਸ ਸਾਲ ਦੇ ਵਿੱਚ ਕਿਉਂਕਿ ਉਸ ਸਮੇਂ ਬੱਚਿਆਂ ਦਾ ਮਨ ਚੰਚਲ ਹੁੰਦਾ ਹੈ ਉਹ ਸਭ ਕੁਝ ਆਪਣੀ ਚਿੱਤਰਕਾਰੀ ਦੇ ਵਿੱਚ ਹੀ ਪ੍ਰਦਰਸ਼ਿਤ ਕਰਦੇ ਹਨ ਅਤੇ ਉਸ ਵਿੱਚ ਉਹ ਉਸ ਸਮੇਂ ਉਹਨਾਂ ਦੀ ਇਸਦੇ ਵਿੱਚ ਕਾਫ਼ੀ ਰੁੱਚੀ ਵੀ ਹੁੰਦੀ ਹੈ ਨਈ ਨਈ ਨਵੀਂ ਨਵੀਂ ਕਲਾਵਾਂ ਨੂੰ ਸਿੱਖਣ ਦੀ ਰੁੱਚੀ